ਰੂਪਨਗਰ ਜ਼ਿਲ੍ਹੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਬਹੁਤ ਹੀ ਵਧੀਆ ਹੈਗਾ ਹੈ ਅਗਰ ਤੁਸੀਂ ਦੇਖਿਆ ਜਾਏ ਇੱਕ ਕਿਡਨੀ ਦਾ ਅਗਰ ਪੇਸ਼ੈਂਟ ਹੈਗਾ ਜਿਹਦੀ ਡਾਇਲੈਸਿਸ ਹੋ ਰਹੀ ਹੈ ਉਹਨੂੰ ਪੀਜੀਆਈ ਨਹੀਂ ਜਾਣਾ ਪਏਗਾ ਉਹ ਤੁਹਾਨੂੰ ਜਿਹੜਾ ਡੀ ਐੱਚ ਰੂਪਨਗਰ ਦਾ ਹਸਪਤਾਲ ਹੈਗਾ ਉੱਥੇ ਵੀ ਤੁਹਾਨੂੰ ਉਹ ਮਿਲ ਜੇਗੀ ਪੇਸ਼ੈਂਟ ਨੂੰ ਜਿਹੜੀ ਖੱਜਲ ਖੁਆਰੀ ਪੀਜੀਆਈ ਜਾ ਕੇ ਨਹੀਂ ਕਰਵਾਉਣੀ ਪਏਗੀ ਉਹ ਡਾਇਲੈਸਿਸ ਇੱਥੇ ਵੀ ਕਰਵਾ ਸਕਦਾ ਹੈ ਇੱਥੇ ਡਾਕਟਰਾਂ ਵੱਲੋਂ ਕਾਫੀ ਸਹੂਲਤਾਂ ਸੇਵਾਵਾਂ ਉਪਲਬਧ ਹਨ ਹੈਗੀਆਂ ਜੋ ਟਵਿੰਟੀ ਫੋਰ ਆਵਰ ਸਰਵਿੱਸ ਹੈ ਐਮਰਜੈਂਸੀ ਓਪਨ ਰਹਿੰਦੀ ਹੈਗੀ ਹੈ ਇੱਥੇ ਸਥਾਨਕ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਜਿਵੇਂ ਜਿਹੜੀ ਪੈਸ਼ੈਂਟ ਦੀ ਹੈਗੀ ਹੈ ਸਿਹਤ ਦੀ ਸੰਭਾਲ ਡਾਕਟਰੀ ਸਹੂਲਤਾਂ ਤੁਹਾਨੂੰ ਹਰ ਇੱਕ ਚੀਜ਼ ਮਿਲੇਗੀ ਉਹਨਾਂ ਦੀਆਂ ਸੇਵਾਵਾਂ ਟਵੰਟੀ ਫੋਰ ਆਵਰਸ ਹੈਗੀਆ ਏ ਜਿਵੇਂ ਤੁਸੀਂ ਕਹਿ ਦੋ ਤੁਸੀਂ ਅਗਰ ਐਂਬੂਲੈਂਸ ਚਾਹੀਦੀ ਹੈਗੀ ਹੈ ਜਾਂ ਕਿਸੇ ਨੂੰ ਬਲੱਡ ਦਾ ਹੈਗਾ ਹੈ ਅਤੇ ਹਰ ਇੱਕ ਚੀਜ਼ ਅਵੇਲੇਵਲ ਹੈਗਾ ਹੈ ਬਲੱਡ ਬੈਂਕ ਦੀ ਵੀ ਇੱਥੇ ਪਰੋਪਰ ਸਹੂਲਤ ਹੈਗੀ ਹੈ ਜੀ